ਮੇਰੇ ਕੋਲ ਨਾ ਐੱਮ ਆਈ ਦਾ ਫ਼ੋਨ ਸੀਗਾ ਉਹ ਬ੍ਰੈਂਡ ਕੋਈ ਜ਼ਿਆਦਾ ਵਧੀਆ ਨਹੀਂ ਹੈਗਾ ਨਾ ਤਾਂ ਉਹਦੀ ਕੈਮਰਾ ਕੁਆਲਿਟੀ ਜ਼ਿਆਦਾ ਵਧੀਆ ਹੈ ਠੀਕ ਹੈ ਸਿਕਿਓਰਿਟੀ ਤਾਂ ਉਹਦੀ ਬਿਲਕੁਲ ਨਹੀਂ ਹੈਗੀ ਉਹਦੀ ਡਿਸਪਲੇਅ ਵੀ ਨਹੀਂ ਇੰਨੀ ਵਧੀਆ ਹੈਗੀ ਠੀਕ ਹੈ ਜਿਹੜੇ ਉਹਦੇ ਸਪੀਕਰ ਆ ਉਹ ਸਹੀ ਤਰੀਕੇ ਨਾਲ ਕੰਮ ਨਹੀਂ ਸੀ ਕਰਦੇ ਠੀਕ ਆ ਅਤੇ ਉਹ ਵਾਟਰਪ੍ਰੂਫ਼ ਵੀ ਨਹੀਂ ਹੁੰਦਾ ਠੀਕ ਆ ਜੀ ਅਤੇ ਉਹਦੀ ਜਿਹੜੀ ਬੈਟਰੀ ਬੈਕਅੱਪ ਆ ਉਹ ਤਾਂ ਬਿਲਕੁਲ ਗਿਆ ਗੁਜ਼ਰਿਆ ਹੁੰਦਾ ਹੈ ਠੀਕ ਹੈ ਉਹ ਬਹੁਤ ਜ਼ਿਆਦਾ ਛੇਤੀ ਲੋਅ ਹੋ ਜਾਂਦਾ ਹੈ ਅਤੇ ਇਹ ਬ੍ਰੈਂਡ ਬਿਲਕੁਲ ਵਧੀਆ ਨਹੀਂ ਹੈਗਾ